ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਥੋਹਾਤੋਂ ਔਨਲਾਈਨ ਪ੍ਰੈੱਸ ਮੰਗਵਾਈ ਸੀ ਉਹ ਬਹੁਤ ਵਧੀਆ ਨਿਕਲੀ ਹੈ ਠੀਕ ਹੈ ਘੱਟ ਵੱਧ ਵੀ ਹੁੰਦੀ ਹੈ ਅਤੇ ਪਾਣੀ ਦਾ ਪ੍ਰੈਸ਼ਰ ਵੀ ਹੈ ਜਿਸ ਕਰਕੇ ਕੱਪੜੇ ਠੀਕ ਹਨ ਉਹ ਪ੍ਰੈੱਸ ਦੀ ਹਰ ਕਿਸੀ ਨੇ ਤਰੀਫ਼ ਕੀਤੀ ਹੈ ਅਤੇ ਮੇਰੇ ਕੋਲ ਹੋਰ ਵੀ ਸਾਡੇ ਰਿਸ਼ਤੇਦਾਰ ਅਤੇ ਪੜੋਸੀ ਹਨ ਜਿਹੜੇ ਇਹ ਮੇਥੋਂ ਪ੍ਰੈੱਸ ਮੰਗ ਰਹੇ ਹਨ ਅਤੇ ਜੇ ਤੁਹਾਨੂੰ ਕੋਈ ਇਤਰਾਜਗੀਰੀ ਨਾ ਹੋਵੇ ਵੀ ਹਾਂ ਕੋਈ ਮੁਸ਼ਕਲ ਨਾ ਹੋਵੇ ਤਾਂ ਮੈਂ ਥੋਹਾਤੋਂ ਐਂਵੇਂ ਦੀ ਔਡਰ ਕਰਕੇ ਹੋਰ ਪ੍ਰੈੱਸ ਮੰਗਾ ਸਕਦੀ ਹਾਂ ਧੰਨਵਾਦ ਜੀ